ਹਾਂ ਮੈਂ ਟੈਕਸ ਬਾਰੇ ਜਾਣਕਾਰੀ ਰੱਖਦੀ ਹਾਂ ਕਿਉਂਕਿ ਮੈਂ ਪਹਿਲਾਂ ਬੀ ਬੀ ਏ ਵਿੱਚ ਇਨਕਮ ਟੈਕਸ ਵਾਲਾ ਸਬਜੈਕਟ ਪੜ੍ਹ ਚੁੱਕੀ ਹਾਂ ਜਿਸ ਵਿੱਚ ਸਾਨੂੰ ਟੈਕਸਾ ਟੈਕਸ ਬਾਰੇ ਡਾਇਰੈਕਟ ਅਤੇ ਇਨਡਾਇਰੈਕਟ ਟੈਕਸ ਬਾਰੇ ਚੰਗੀ ਤਰ੍ਹਾਂ ਦੱਸਿਆ ਗਿਆ ਹੈ ਟੈਕਸ ਸਾਡੇ ਲਈ ਕਿਉਂ ਜ਼ਰੂਰੀ ਹੈ ਇਹ ਸਰਕਾਰ ਦੁਆਰਾ ਲਗਾਏ ਜਾਂਦੇ ਆ ਲੋਕਾਂ ਅਤੇ ਕਾਰੋਬਾਰ ਤੋਂ ਜਨਤਕ ਸੇਵਾਵਾਂ ਅਤੇ ਪ੍ਰੋਜੈਕਟਾਂ ਨੂੰ ਚਲਾਉਣ ਲਈ ਲਗਾਏ ਜਾਂਦੀ ਹੈ ਟੈਕਸਾਂ ਦੀਆਂ ਵੱਖ ਵੱਖ ਕਿਸਮਾਂ ਹਨ ਜਾਂ ਆਮ ਤੌਰ 'ਤੇ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡੀਆਂ ਜਾਂਦੀਆਂ ਹਨ ਡਾਇਰੈਕਟ ਟੈਕਸ ਅਤੇ ਇਨਡਾਇਰੈਕਟ ਟੈਕਸ ਡਾਇਰੈਕਟ ਟੈਕਸ ਉਹ ਹੁੰਦੇ ਹਨ ਜੋ ਸਿੱਧੇ ਤੌਰ 'ਤੇ ਕਿਸੇ ਵੀ ਵਿਗ ਵਿਅਕਤੀ ਜਾਂ ਸੰਗਠਨ 'ਤੇ ਲਗਾਏ ਜਾਂਦੇ ਹਨ ਜਿਵੇਂ ਕਿ ਇਨਕਮ ਟੈਕਸ ਕੋਰਪਰੇਟ ਟੈਕਸ ਪ੍ਰੋਪਰਟੀ ਟੈਕਸ ਇਹ ਡਾਇਰੈਕਟ ਟੈਕਸ ਹੁੰਦੇ ਹਨ ਇਹ ਟੈਕਸ ਕਿਸੇ ਵੀ ਵਿਅਕਤੀ ਜਾਂ ਕਾਰਪੋਰੇਸ਼ਨ ਦੀ ਆਮਦਨੀ 'ਤੇ ਲਗਾਇਆ ਜਾਂਦਾ ਹੈ ਕੰਪਨੀ ਟੈਕਸ ਇਹ ਟੈਕਸ ਕੰਪਨੀਆਂ ਦੀਆਂ ਕਮਾਈਆਂ ਉੱਤੇ ਲਗਾਇਆ ਜਾਂਦਾ ਹੈ ਜਦੋਂ ਕਿਸੇ ਕੰਪਨੀ ਦੀ ਆਮਦਨ ਵੱਧ ਹੁੰਦੀ ਹੈ ਤਾਂ ਉਹ ਉਸ ਕੰਪਨੀ ਦੀ ਆਮਦਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਟੈਕਸ ਦੀ ਟੈਕਸ ਨੂੰ ਲਗਾਇਆ ਜਾਂਦਾ ਹੈ ਅਤੇ ਪ੍ਰੋਪਰਟੀ ਟੈਕਸ ਇਹ ਟੈਕਸ ਜਾਇਦ ਜਾਇਦਾਦ ਉੱਤੇ ਲਗਾਇਆ ਜਾਂਦਾ ਹੈ ਜਿਵੇਂ ਕਿ ਮਕਾਨ ਜਮੀਨ ਅਤੇ ਦੂਜਾ ਆਉਂਦਾ ਇਨਡਾਇਰੈਕਟ ਟੈਕਸ ਇਨਡਾਇਰੈਕਟ ਟੈਕਸ ਉਹ ਹੁੰਦੇ ਆ ਜੋ ਸਿੱਧੇ ਤੌਰ 'ਤੇ ਨਹੀਂ ਬਲਕਿ ਕਿਸੇ ਵਸਤੂ ਜਾਂ ਸੇਵਾਵਾਂ 'ਤੇ ਲਗਾਏ ਜਾਂਦੇ ਹਨ ਜੋ ਭੁਗਤਾਨ ਵਿਅਕਤੀ ਦੁਆਰਾ ਹੀ ਕੀਤਾ ਜਾਂਦਾ ਹੈ ਜਿਵੇਂ ਗੁਡਜ ਐਂਡ ਸਰਵਿਸਿਸ ਟੈਕਸ ਜਿਹਨੂੰ ਆਪਾਂ ਜੀ ਐਸ ਟੀ ਟੈਕਸ ਵੀ ਜੀ ਐਸ ਟੀ ਵੀ ਕ ਕਹਿੰਦੇ ਹਾਂ ਇਹ ਟੈਕਸ ਵੱਖ ਵੱਖ ਵਸਤੂਆਂ ਅਤੇ ਸੇਵਾਵਾਂ 'ਤੇ ਲਗਾਇਆ ਜਾਂਦਾ ਹੈ ਕਸਟਮਸ ਡਿਊਟੀ ਇਹ ਟੈਕਸ ਇੰਪੋਰਟ ਜਾਂ ਐਕਸਪੋਰਟ ਕੀਤੀਆਂ ਵਸਤੂਆਂ 'ਤੇ ਲਗਾਇਆ ਜਾਂਦਾ ਹੈ ਅਤੇ ਤੀਸਰਾ ਇੰਨਡਾਇਰੈਕਟ ਟੈਕਸ ਹੈਗਾ ਐਕਸਾਈਜ਼ ਡਿਊਟੀ ਇਹ ਟੈਕਸ ਦੇਸੀ ਪੈਮਾਨੇ ਅਤੇ ਉਤਪਾਦਿਤ ਕੀਤੀਆਂ ਵਸਤੂਆਂ 'ਤੇ ਲਗਾਇਆ ਜਾਂਦਾ ਹੈ ਟੈਕਸਾਂ ਲਈ ਪੈਸੇ ਦੀ ਕਟੌਤੀ ਦੇ ਪ੍ਰਤੀਸ਼ਤ ਦੀ ਪ੍ਰਸੈਂਟਿਜ਼ ਪੈਸੇ ਦੀ ਕਟੌਤੀ ਜਾਂ ਟੈਕਸ ਡਿਡਕਸ਼ਨ ਦੇ ਅਰਥ ਕਿਸੇ ਵੀ ਵਿਅਕਤੀ ਜਾਂ ਕਾਰੋਬਾਰ ਦੀ ਕੁੱਲ ਆਮਦਨ ਜਾ ਉਹ ਹਿੱਸਾ ਜੋ ਟੈਕਸ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਜਿਵੇਂ ਕਿ ਆਮਦਨੀ ਟੈਕਸ ਰੇਟ ਵਿਅਕਤੀ ਅਤੇ ਕੰਪਨੀਆਂ ਦੀ ਆਮਦਨੀ ਟੈਕਸ ਦੀਆਂ ਵੱਖ ਵੱਖ ਦਰ੍ਹਾਂ ਹੁੰਦੀਆਂ ਨੇ ਜਿਹੜੀਆਂ ਆਮਦਨੀ ਦੇ ਲੈਵਲ ਅਤੇ ਕਿਸਮ ਦੇ ਆਧਾਰ 'ਤੇ ਨਿਰਧਾਰਿਤ ਕੀਤੀ ਨਿਰਧਾਰਿਤ ਹੁੰਦੀਆਂ ਹਨ ਜਿਵੇਂ ਜੀ ਐਸ ਟੀ ਟੈਕਸ ਰੇਟ ਪੰਜ ਪ੍ਰਸੈਂਟ ਬਾਰ੍ਹਾਂ ਪ੍ਰਸੈਂਟ ਅਠਾਰਾਂ ਅਤੇ ਅਠਾਈ ਪ੍ਰਸੈਂਟ ਇਹ ਚਾਰ ਮੁੱਖ ਵੱਖ ਵੱਖ ਰੇਟਾਂ ਦੇ ਜੀ ਐਸ ਟੀ ਟੈਕਸ ਹਨ ਜੋ ਕਿ ਵਿਅਕਤੀ ਦੁਆਰਾ ਪੇ ਕੀਤੇ ਜਾਂਦੇ